ਪੰਜਾਬ 'ਚ ਦੇਖੋ ਜੀ ਇੱਕ ਤਾਂ ਟੈਕਸ ਲੱਗਦਾ ਹੈ ਤੁਸੀਂ ਆਪਣਾ ਪ ਬਿਜਨਸ ਕਰ ਰਹੇ ਹੋ ਤਾਂ ਤੁਹਾਨੂੰ ਟੈਕਸ ਪੇਅ ਕਰਨਾ ਪਏਗਾ ਜੇ ਟੈਕਸ ਪੇਅ ਨਹੀਂ ਕੀਤਾ ਤਾਂ ਤੁਹਾਡਾ ਬਿਜਨਸ ਉਹ ਬੰਦ ਵੀ ਕਰ ਸਕਦੇ ਹੈ ਸਹੀ ਤਰੀਕੇ ਨਾਲ ਟੈਕਸ ਦੀ ਪੇਮੈਂਟ ਕਰਨੀ ਪੈਂਦੀ ਹੈ ਨਾਲੇ ਵਾਤਾਵਰਨ ਕਾਰਨ ਜਾਣੀ ਜੇ ਕਿਹੜਾ ਕਿ ਤੁਸੀਂ ਕੰਮ ਕਰ ਰਹੇ ਹੋ ਉਸਦੇ ਰਾਹੀਂ ਵਾਤਾਵਰਨ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ ਅਤੇ ਜੇ ਤੁਸੀਂ ਨੁਕਸਾਨ ਕਰਦੇ ਹੋ ਤਾਂ ਸਰਕਾਰ ਤੁਹਾਡੇ ਬਿਜਨਸ ਉੱਤੇ ਤੁਹਾਡੇ ਕੰਪਨੀ ਦੇ ਉੱਤੇ ਜਾਂ ਤੁਹਾਡੇ ਕੰਮ ਦੇ ਉੱਤੇ ਰੋਕ ਵੀ ਲਗਾ ਸਕਦੀ ਹੈ